ਸਤਿ ਸ਼੍ਰੀ ਅਕਾਲ ਜੀ ਤੁਸੀਂ ਭੈਣਾਂ ਦੇ ਢਾਬੇ ਤੋਂ ਬੋਲ ਰਹੇ ਹੋ ਮੈਂ ਗਿਆਰ੍ਹਾਂ ਕੁ ਵਜੇ ਆਪ ਜੀ ਨੂੰ ਸ਼ਾਹੀ ਪਨੀਰ ਦਾਲ ਮੱਖਣੀ ਦਸ ਰੋਟੀਆਂ ਲੱਸੀ ਅਤੇ ਮਿੱਠੇ ਵਿੱਚ ਸੇਵੀਆਂ ਮੰਗਵਾਈਆਂ ਸਨ ਪ੍ਰੰਤੂ ਮੇਰੇ ਭਰਾ ਪਾਸੋਂ ਔਡਰ ਪ੍ਰਾਪਤ ਕੀਤਾ ਗਿਆ ਉਸ ਵੱਲੋਂ ਲੱਸੀ ਕਿਤੇ ਗਿਰ ਗਈ ਹੈ ਇਸ ਲਈ ਆਪ ਨੂੰ ਦੁਬਾਰਾ ਲੱਸੀ ਦਾ ਆਡਰ ਅਤੇ ਇਸਦੇ ਨਾਲ ਹੀ ਮਿਸਟ ਵੈੱਜ ਦੀ ਸਬਜ਼ੀ ਅਤੇ ਦਹੀਂ ਮੇਰੇ ਆਡਰ ਵਿੱਚ ਜੋੜ ਲਈ ਜਾਵੇ ਜੀ ਕਿਉਂਕਿ ਜਿਹੜਾ ਆਡਰ ਮੈਂ ਪਹਿਲਾਂ ਮੰਗਵਾਇਆ ਸੀ ਉਹ ਭੋਜਨ ਬਹੁਤ ਹੀ ਸਵਾਦ ਸੀ ਅਤੇ ਮੇਰੇ ਮਹਿਮਾਨਾਂ ਨੂੰ ਬਹੁਤ ਪਸੰਦ ਆਇਆ ਪ੍ਰੰਤੂ ਲੱਸੀ ਨਾ ਹੋਣ ਕਾਰਨ ਇਹ ਅਧੂਰਾ ਜਿਹਾ ਲੱਗਿਆ ਇਸ ਲਈ ਆਪ ਨੂੰ ਦੁਬਾਰਾ ਤੋਂ ਲੱਸੀ ਦਾ ਅਤੇ ਇਸ ਦੇ ਨਾਲ ਹੀ ਮਿਕਸ ਵੈੱਜ ਦੀ ਸਬਜ਼ੀ ਅਤੇ ਦਹੀਂ ਦਾ ਆਡਰ ਦੇ ਰਹੀ ਹਾਂ ਕਿਰਪਾ ਕਰਕੇ ਜਦੋਂ ਇਹ ਆਡਰ ਤਿਆਰ ਹੋ ਜਾਵੇ ਤਾਂ ਤੁਸੀਂ ਸਾਨੂੰ ਸੂਚਿਤ ਕਰ ਦੇਣਾ ਤਾਂ ਜੋ ਮੈਂ ਆਪਣੇ ਭਰਾ ਨੂੰ ਆਡਰ ਲੈਣ ਲਈ ਦੁਬਾਰਾ ਤੋਂ ਭੇਜ ਸਕਾਂ ਜੀ